ਹੈਲੋ ਨਮਸਕਾਰ ਬੇਟਾ ਜੀ ਗੱਲ ਸੁਣੋ ਅਸੀਂ ਲੈਂਡਲੋਡ ਤੁਹਾਡੇ ਕੋਲੋਂ ਕੁਨੈਕਸ਼ਨ ਲਿਆ ਹੈਗਾ ਸੀ ਨਾ ਇੰਟਰਨੈੱਟ ਦਾ ਇੰਟਰਨੈੱਟ ਨੈੱਟ ਲਿਆ ਸੀ ਅਤੇ ਤੁਹਾਡਾ ਜਿਹੜਾ ਵਾਈਫਾਈ ਉਹ ਸਹੀ ਤਾਂ ਚਲਦਾ ਨਹੀਂ ਪਿਆ ਕਿਉਂਕਿ ਆਪਾਂ ਤੇ ਤਾਂ ਹੀ ਲਿਆ ਸੀ ਤਾਂ ਹੀ ਤਾਂ ਪੈਸੇ ਖਰਚੇ ਵੀ ਚਲੋ ਸਾਡਾ ਨੈੱਟ ਸਹੀ ਚੱਲੇ ਉਹ ਤਾਂ ਨਾ ਹੀ ਹੁਣ ਸਾਡਾ ਨੈੱਟ ਸਹੀ ਚੱਲਦਾ ਨਾ ਕੋਈ ਬੱਚਿਆਂ ਦੇ ਉੱਤੇ ਵਗੈਰਾ ਕ ਵਰਕ ਵਗੈਰਾ ਕੰਮ ਆਉਂਦਾ ਵਾ ਨਾ ਸਾਡੇ ਫੋਨ ਚੱਲਦੇ ਆ ਸਹੀ ਤਰ੍ਹਾਂ ਅੱਗੇ ਸਹੀ ਚੱਲਦਾ ਸੀ ਅਤੇ ਅਸੀਂ ਤਾਂ ਹੀ ਲਈ ਸੀ ਤੁਸੀਂ ਸਾਨੂੰ ਸਕੀਮ ਦਿੱਤੀ ਸੀ ਅਤੇ ਅਸੀਂ ਲਈ ਤੁਹਾਡੇ ਕੋਲੋਂ ਅਤੇ ਕੋਈ ਫ਼ਾਇਦਾ ਤਾਂ ਹੋਇਆ ਨਹੀਂ ਹੈਗਾ ਸਾਨੂੰ ਤੇ ਇਸ ਕਰਕੇ ਤੁਸੀਂ ਨਾ ਇਹਨੂੰ ਠੀਕ ਤਾਂ ਕਰਨਾ ਹੀ ਹੈਗਾ ਨਾ ਅਤੇ ਨਾ ਤੁਸੀਂ ਇਹਨੂੰ ਠੀਕ ਕਰਨ ਲਈ ਕੋਈ ਨਾ ਕੋਈ ਭੇਜੋ ਮੈਂਬਰ ਆਪਣਾ ਅਤੇ ਦੇਖੋ ਅਸੀਂ ਤਾਂ ਆਪਾਂ ਇਹ ਸਕੀਮ ਲਈ ਸੀ ਆਪਾਂ ਦੋ ਤਿੰਨ ਮਹੀਨੇ ਹੁਣ ਇਹਦਾ ਰੀਚਾਰਜ ਵੀ ਕਰਵਾਇਆ ਸੀ ਸਾਨੂੰ ਫ਼ਾਇਦਾ ਤਾਂ ਨਹੀਂ ਨਾ ਆਪਾਂ ਤਿੰਨ ਮਹੀਨੇ ਦਾ ਰੀਚਾਰਜ ਕਰਵਾ ਦਿੱਤਾ ਤੁਹਾਨੂੰ ਪੈਸੇ ਦੇ ਕੇ ਅਤੇ ਕੋਈ ਫ਼ਾਇਦਾ ਤਾਂ ਸਾਡਾ ਹੋਇਆ ਨਹੀਂ ਹੈਗਾ ਇਸ ਕਰਕੇ ਸਾਡਾ ਇਹ ਫੋਨ ਤੁਹਾਨੂੰ ਠੀਕ ਕਰਨਾ ਚਾਹੀਦਾ ਨਹੀਂ ਆ ਕੇ ਤ ਤਾਂ ਹੀ ਆਪਾਂ ਬੱਚਿਆਂ ਨੂੰ ਕਰ ਸਕਾਂਗੇ ਨਾ ਅਤੇ ਸਾਡੇ ਵੀ ਫੋਨ ਵਗੈਰਾ ਵੀ ਚੱਲਣ ਫਿਰ ਤਾਂ ਸਾਨੂੰ ਫ਼ਾਇਦਾ ਇੱਦਾਂ ਸਾਨੂੰ ਕੋਈ ਫ਼ਾਇਦਾ ਫੁਇਦਾ ਨਹੀਂ ਹੈਗਾ ਇਹਦਾ ਇਸ ਕਰਕੇ ਨਹੀਂ ਤਾਂ ਆਪਣਾ ਕਨੈਕਸ਼ਨ ਕੱਟ ਕੇ ਲੈ ਜਾਓ ਬਹੁਤੀ ਗੱਲ ਹੈ ਤਾਂ ਨਹੀਂ ਨਹੀ ਤਾਂ ਆਹੋ ਨਹੀਂ ਤਾਂ ਕਨੈਕਸ਼ਨ ਕੱਟ ਕੇ ਲੈ ਜਾਓ ਅਤੇ ਜਾਂ ਆਪਣੇ ਬੰਦੇ ਭੇਜੋ ਇੱਥੇ ਆ ਕੇ ਠੀਕ ਕਰ ਜਾਣ ਜੇ ਤੁਸੀਂ ਠੀਕ ਹੀ ਨਹੀਂ ਕੀਤਾ ਤਾ ਫਿਰ ਫ਼ਾਇਦਾ ਨਹੀਂ ਜੋ ਇੱਕ ਦੋ ਦਿਨ ਤੱਕ ਨਹੀਂ ਨਾ ਆਏ ਤਾਂ ਆਪਾਂ ਕਨੈਕਸ਼ਨ ਕੱਟ ਕੇ ਉਹ ਮਾਰਨੇ ਫਿਰ ਨਾ ਕਿਹੋ ਭਰਾਵਾ ਛੇਤੀ ਆਜਾ ਅਤੇ ਸਾਡਾ ਕਨੈਕਸ਼ਨ ਠੀਕ ਕਰਕੇ ਜਾਓ ਸਾਨੂੰ ਲੋੜ ਹੈਗੀ ਆ ਜੇ ਬੱਚਿਆਂ ਨੂੰ ਲੋੜ ਹੀ ਨਹੀਂ ਪੂਰੀ ਹੋਈ ਤਾਂ ਸਾਨੂੰ ਕਰਨ ਦਾ ਵੀ ਇੱਥੇ ਰੱਖਣ ਦਾ ਵੀ ਕੀ ਫ਼ਾਇਦਾ ਪੈਸੇ ਖਰਚਣ ਦਾ ਮਤਲਬ ਹੀ ਕੋਈ ਨਹੀਂ ਬਣਦਾ ਤਾਂ ਆਪਾਂ ਲੱਗੇ ਤੇਰਾ ਕਨੈਕਸ਼ਨ ਕੱਟਣ ਫਿਰ ਨਾ ਕਹੀਂ ਹਾਂ ਵਾਧੂ ਫਿਰ ਨਾ ਕਹੀਂ